ਯਾਤਰਾ ਕਰਨ ਅਸੀ ਬਾਹਰ ਗਏ ਜਿਸ ਤਰਾਂ ਕਿ ਵੈਸ਼ਨੋ ਦੇਵੀ ਵੈਸ਼ਨੋ ਦੇਵੀ ਜਾ ਕੇ ਉੱਥੇ ਸਾਡੇ ਨਾਲ ਕੋਈ ਵਕਤ ਬਾਤ ਨਹੀਂ ਕੀਤਾ ਸਮਕਾ ਉਹ ਤਾਂ ਬੰਦੇ ਸਾਨੂੰ ਬਹੁਤ ਪਿਆਰ ਨਾਲ ਬੋਲਦੇ ਸਨ ਸਾਨੂੰ ਜਿੱਥੇ ਅਸੀਂ ਬੈਠਣਾ ਸਾਡੇ ਨਾਲ ਬੈਠ ਕੇ ਗੱਲਾਂ ਕਰਦੇ ਸਨ ਸਾਨੂੰ ਆਪਣੇ ਨਾਲ ਬਿਠਾ ਕੇ ਰੋਟੀ ਦਿੰਦੇ ਕਿ ਲਓ ਸਾਡੇ ਨਾਲ ਰੋਟੀ ਖਾਓ ਉਹਨਾਂ ਨੇ ਸਾਨੂੰ ਕੋਈ ਪੇ ਨਹੀਂ ਕੀਤਾ ਤੁਸੀਂ ਪੰਜਾਬ ਤੋਂ ਆਏ ਹੋ ਜਾਂ ਤੁਸੀਂ ਹਰਿਆਣੇ ਤੋਂ ਆਏ ਹੋ ਕੋਈ ਵਕਤ ਪਾਤ ਸਾਡੇ ਨਾਲ ਕੋਈ ਨਹੀਂ ਕੀਤਾ ਉਹਨਾਂ ਨੇ ਉਹ ਤਾਂ ਬਹੁਤ ਪਿਆਰ ਨਾਲ ਸਾਡੇ ਨਾਲ ਮਿਲਦੇ ਸੀ ਮਿਲਦੇ ਸਨ ਅਤੇ ਸਾਡੇ ਨਾਲ ਗ ਗੱਲਾਂ ਬਾਤਾਂ ਵੀ ਆਪਣੇ ਘਰ ਪਰਿਵਾਰ ਦੀਆਂ ਵੀ ਕਰਦੇ ਸਨ ਜਿਸ ਕਰਕੇ ਸਾਨੂੰ ਉਹਨਾਂ ਦੇ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਉਸ ਤੋਂ ਬਾਅਦ ਅਮਰਨਾਥ ਗਿਆ ਅਮਰਨਾਥ ਦੀ ਯਾਤਰਾ ਕੀਤੀ ਅਮਰਨਾਥ ਦੀ ਯਾਤਰਾ ਤਾਂ ਬਹੁਤ ਵੱਡੀ ਯਾਤਰਾ ਹੁੰਦੀ ਹੈ ਜਿਸ ਕਰਕੇ ਸਾਨੂੰ ਉੱਥੇ ਵੀ ਕੋਈ ਵਕਤ ਪਾਤ ਨਹੀਂ ਕੀਤਾ ਕਿਸੇ ਨੇ ਸਾਰੇ ਪਿਆਰ ਨਾਲ ਮਿਲਦੇ ਸਨ ਪਿਆਰ ਨਾਲ ਖਾਣਾ ਖਾਂਦੇ ਖਾਣਾ ਵੀ ਉੱਥੇ ਫਰੀ ਮਿਲਦਾ ਸੀਗਾ ਜੋ ਸੇਵਾਦਾਰ ਬਹੁਤ ਚੰਗੇ ਹੁੰਦੇ ਸਨ ਚੰਗੀਆਂ ਉਹਨਾਂ ਨੇ ਸਭ ਨੂੰ ਬਲ ਬਿਠਾ ਕੇ ਖਾਣਾ ਖਿਲਾਣਾ ਚਾਟ ਖਿਲਾਣੀ ਗੋਲ ਗੱਪੇ ਖਿਲਾਣੇ ਇੱਦਾਂ ਦੇ ਵੀ ਭੋਜਨ ਸੀਗੇ ਕਿ ਜੋ ਅਸੀਂ ਵਿਆਹ ਸ਼ਾਦੀਆਂ 'ਚ ਖਾਂਦੇ ਸਨ ਅਮਰਨਾਥ ਦੀ ਯਾਤਰਾ 'ਚ ਉਹ ਵੀ ਸਾਨੂੰ ਮਿਲਦੇ ਸਨ ਉਹਨਾਂ ਦੇ ਨਾਲ ਬਹੁਤ ਚੰਗਾ ਸਗੋਂ ਮੇਰੇ ਨਾਲ ਤਾਂ ਉੱਥੇ ਹੋਰ ਪ੍ਰੋਬਲਮ ਆ ਗਈ ਸਾਹ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਉੱਪਰ ਬਰਫ਼ ਜ਼ਿਆਦਾ ਹੁੰਦੀ ਹੈ ਉਹਨਾਂ ਨੇ ਮਿਲ ਕੇ ਉਹਦੇ 'ਤੇ ਉੱਥੇ ਦੀ ਗੌਰਮਿੰਟ ਨੇ ਜਾਂ ਉੱਥੇ ਦੇ ਬੰਦੇ ਜੋ ਰਹਿੰਦੇ ਰਹਿਣ ਵਾਲੇ ਆ ਨਾ ਉਹਨਾਂ ਨੇ ਸਾਨੂੰ ਆਕਸੀਜਨ ਦਿੱਤੀ ਜਿਸ ਕਰਕੇ ਅਸੀਂ ਅਮਰਨਾਥ ਦੀ ਯਾਤਰਾ ਪੂਰੀ ਕਰ ਸਕੇ